ਪਹਿਲਾਂ ਤਾਂ ਸਭ ਤੋਂ ਪਹਿਲਾਂ ਜੇ ਸਾਡੀ ਕੋਈ ਵੀ ਖੇਡ ਹੈਗੀ ਆ ਕਿੰਨੀਆਂ ਗੇਮਾਂ ਹੈਗੀਆਂ ਨੇ ਸਾਰੇ ਗੇਮਾਂ ਦੇ ਰੂਲਸ ਪਹਿਲਾਂ ਹੀ ਫਿਕਸ ਹੁੰਦੇ ਨੇ ਅਤੇ ਸਾਰੀ ਇੰਸਟਰਕਸ਼ਨਸ ਬੱਚਿਆਂ ਨੂੰ ਪਹਿਲਾਂ ਹੀ ਸਮਝਾ ਦਿੱਤੀ ਜਾਂਦੀ ਹੈ ਬੱਟ ਕਈ ਬੱਚੇ ਜਿਹੜੇ ਹੁੰਦੇ ਆ ਜਿਨ੍ਹਾਂ ਨੂੰ ਆਪਣੀ ਅਣਖ ਜਾਰੀ ਰਹਿੰਦੀ ਆ ਜਾਂ ਖੇਡਦੇ ਹੈ ਅੱਗੋਂ ਅਗ੍ਰੇਸਿਵ ਨੇਚਰ ਦੇ ਹੋ ਜਾਂਦੇ ਆ ਉਹਨਾਂ ਦੇ ਲਈ ਕੁਛ ਰੂਲਸ ਬਣਾਏ ਗਏ ਨੇ ਸਪੈਸ਼ਲ ਰੂਲਸ ਹੁੰਦੇ ਆ ਲਾਈਕ ਅਗਰ ਤੁਸੀਂ ਕੋਈ ਖੇਡ ਖੇਡਦੇ ਪਏ ਹੋ ਫੁੱਟਬਾਲ ਖੇਡਦੇ ਪਏ ਹੋ ਅਗਰ ਤੁਸੀਂ ਫੁੱਟਬਾਲ ਦੀ ਵਜਾਏ ਕਿਸੀ ਪਲੇਅਰ ਨੂੰ ਹਿੱਟ ਕਰਦੇ ਹੋ ਅਤੇ ਉਹਨਾਂ ਨੂੰ ਪੇਨਾਲਟੀ ਮਿਲ ਕੇ ਇੱਕ ਵਾਰਨਿੰਗ ਦੇ ਦਿੱਤੀ ਜਾਂਦੀ ਹੈ ਜੇ ਅਗਰ ਉਹ ਵੋਰਨਿੰਗ ਤੋਂ ਬਾਅਦ ਵੀ ਇੱਦਾਂ ਦੀ ਕੋਈ ਹਰਕਤ ਕਰਦਾ ਆ ਤਾਂ ਉਹਨੂੰ ਉਸ ਗੇਮ ਦੇ ਵਿੱਚੋਂ ਦੀ ਰੈੱਡ ਕਾਰਡ ਦੇ ਕੇ ਬਾਹਰ ਕਰ ਦਿੱਤਾ ਜਾਂਦਾ ਆ ਤਾਂ ਕਿ ਉਹ ਕਿਸੇ ਪਲੇਅਰ ਨੂੰ ਹਰਟ ਨਾ ਕਰ ਸਕੇ ਅਤੇ ਨੈਕਸਟ ਟਾਈਮ ਲਈ ਉਹਨੂੰ ਉਹਦੀ ਪਨਿਸ਼ਮੈਂਟ ਦਿੱਤੀ ਜਾਂਦੀ ਹੈ ਅਤੇ ਜੇ ਅਗਰ ਕੋਈ ਪਲੇਅਰ ਅਗਰ ਫਿਰ ਵੀ ਰੂਲ ਰੈਗੂਲੇਸ਼ਨਸ ਨੂੰ ਫੋਲੋ ਨਹੀਂ ਕਰਦਾ ਆ ਕਈ ਪਲੇਅਰਸ ਜਿੱਦਾਂ ਡਰੋਪਿੰਗ ਦੇ ਕੇਸ 'ਚ ਆ ਜਾਂਦੇ ਆ ਜਾਂ ਕੋਈ ਐਕਸਟਰਾ ਜੋ ਚੀਜ਼ ਗੇਮਾਂ ਦੇ ਵਿੱਚ ਅਲਾਊਡ ਨਹੀਂ ਹੈਗੀ ਉਹ ਚੀਜ਼ ਦਾ ਯੂਜ ਕਰਦੇ ਨੇ ਅਤੇ ਉਹਨਾਂ ਦੇ ਵਿੱਚ ਉਹਨਾਂ ਦਾ ਬੈਨ ਲਗਾ ਦਿੱਤਾ ਜਾਂਦਾ ਹੈ ਕਿ ਉਹ ਕੁਛ ਸਮੇਂ ਤੱਕ ਉਸ ਖੇਡ ਨੂੰ ਨਹੀਂ ਖੇਡ ਸਕਦੇ ਅਤੇ ਗੇਮਸ ਦੇ ਵਿੱਚ ਇੱਦਾਂ ਦੇ ਕਈ ਰੂਲਸ ਨੇ ਹੈਗੇ ਨੇ ਜਿਨ੍ਹਾਂ ਦੇ ਕਰਕੇ ਸਪੋਟਸ ਨੂੰ ਇੱਕ ਸਪੋਟਸ ਦੇ ਤਰੀਕੇ ਨਾਲ ਖੇਡਣ ਦੀ ਉਹ ਦੱਸਿਆ ਜਾਂਦਾ ਕਿ ਤੁਸੀਂ ਸਪੋਟਸ ਸਪੋਟਸ ਦੇ ਤਰੀਕੇ ਨਾਲ ਹੀ ਖੇਡੋ ਅਤੇ ਜੇ ਅਗਰ ਕੋਈ ਰੂਲਸ ਤੋੜਦਾ ਆ ਤਾਂ ਉਹਨੂੰ ਡਿਸਕੁਆਲੀਫਾਈ ਕਰ ਕਰ ਦਿੱਤਾ ਜਾਂਦਾ ਹੈ ਜੋ ਕੋਈ ਅਗਰ ਜ਼ਿਆਦਾ ਵੱਡੀ ਕੋਈ ਖੇਡ ਖੇਡਦਾ ਆ ਜਾਂ ਕੋਈ ਸ਼ਰਾਰਤ ਕਰਦਾ ਆ ਤਾਂ ਉਹਦੇ 'ਚ ਪਰੋ ਬੈਨ ਲਗਾ ਦਿੱਤਾ ਜਾਂਦਾ ਆ ਤਾਂ ਕਿ ਉਹ ਗੇਮ ਨੂੰ ਅੱਗੇ ਕੰਟੀਨਿਊ ਨਾ ਕਰ ਸਕੇ ਅਤੇ ਇਹਦੇ ਇੱਕ ਲਾਈਫ ਦਾ ਲੈਸਨ ਵੀ ਮਿਲ ਜਾਂਦਾ ਆ ਕਿਉਂਕਿ ਸਪੋਰਟਸਮੈਨ ਜਿਹੜੀ ਸਪਿਰਿਟ ਹੈਗੀ ਆ ਗੇਮਸ ਦੀ ਜੇ ਸਪਿਰਿਟ ਹੈਗੀ ਆ ਉਹ ਇਹ ਹੈਗੀ ਆ ਕਿ ਤੁਸੀਂ ਮਿਲ ਕੇ ਖੇਲਣਾ ਆ ਤੁਸੀਂ ਇੱਕ ਚੀਜ਼ ਨੂੰ ਰਿਪ੍ਰੇਜੈਂਟ ਕਰਦੇ ਹੋ ਸਕੂਲ ਦੇ ਬੱਚੇ ਸਕੂਲ ਨੂੰ ਰਿਪ੍ਰੇਜੈਂਟ ਕਰਦੇ ਨੇ ਅਗਰ ਉਹ ਹੀ ਬੱਚੇ ਜੋ ਅੱਛਾ ਖੇਡਦੇ ਨੇ ਅਗਰ ਕਾਬਿਲ ਹੈਗੇ ਨੇ ਤਾਂ ਅਗਾਂਹ ਜਾ ਕੇ ਆਪਣੀ ਸਟੇ ਸਟੇਟ ਨੂੰ ਆਪਣੇ ਦੇਸ਼ ਨੂੰ ਰਿਪ੍ਰੇਜੈਂਟ ਕਰਦੇ ਨੇ ਤੋ ਉਹਨਾਂ ਦੇ ਵਿੱਚ ਖੇਡ ਭਾਵਨਾ ਹੋਣੀ ਚਾਈਦੀ ਹੈ ਅਤੇ ਇਹੋ ਜਿਹਾ ਕੋਈ ਉਹ ਨਹੀਂ ਹੋਣਾ ਚਾਈਦਾ ਜਿਹਦੇ ਚੋਂ ਰੂਲ ਦੀ ਉਲੰਘਣਾ ਕਰਨ ਅਗਰ ਜੇ ਰੂਲ ਦੀ ਉਲੰਘਣਾ ਕਰਦੇ ਹੈ ਜੇ ਰੂਲ ਨਹੀਂ ਫੋਲੋ ਕਰਦੇ ਤਾਂ ਉਹਨਾਂ ਨੂੰ ਗੇਮ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ